ਹਾਂਜੀ ਹੈਲੋ ਪ੍ਰਬੰਧਕ ਕਮੇਟੀ ਜੀ ਅਸੀਂ ਆਪ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਅਸੀਂ ਆਪਣੇ ਮਹੱਲਾ ਅਵਤਾਰ ਦਿਲਬਾਗ ਨਗਰ ਦੇ ਵਿੱਚ ਪਾਰਕ ਦੇ ਵਿੱਚ ਇੱਕ ਕਮੇਟੀ ਕੰਮਿਊਨਟੀ ਪ੍ਰੋਗਰਾਮ ਦਾ ਆਯੋਜਨ ਕਰ ਰਹੇ ਹਾਂ ਜਿਨ੍ਹਾਂ ਵਿੱਚ ਕਾਫੀ ਤਰ੍ਹਾਂ ਦੇ ਲੋਕ ਮਤਲਬ ਕਿ ਬਹੁਤ ਗਿਣਤੀ ਦੇ ਵਿੱਚ ਲੋਕ ਆਉਣ ਦੀ ਸੰਭਾਵਨਾ ਹੈ ਅਤੇ ਉਹਨਾਂ ਦੇ ਵੱਲੋਂ ਦੌਰਾਨ ਉੱਥੇ ਖਾਣ ਪੀਣ ਦਾ ਪ੍ਰੋਗਰਾਮ ਵੀ ਉਪਲਬਧ ਹੈ ਅਤੇ ਜਿਨ੍ਹਾਂ ਦੇ ਕਾਰਨ ਜੋ ਉਹਨਾਂ ਦਾ ਉਸ ਤੋਂ ਬਾਅਦ ਡਿਸਪੋਜੇਬਲ ਕਚਰਾ ਜਾਂ ਕੂੜਾ ਸੁੱਟਿਆ ਜਾਵੇਗਾ ਉਨਾਂ ਨੂੰ ਉਹਨਾਂ ਉਹਦੀ ਦੇਖ ਰੇਖ ਜਾਂ ਉਹਨਾਂ ਨੂੰ ਸੰਭਾਲ ਚੁੱਕਣ ਦੀ ਇਹ ਬੇਨਤੀ ਹੈ ਜੀ ਆਪਣੇ ਕਰਮਚਾਰੀ ਭੇਜੋ ਅਤੇ ਉਹਨਾਂ ਨੂੰ ਭੇਜ ਦੇਣਾ ਅਤੇ ਉਹਨਾਂ ਨੂੰ ਵੀ ਤੁਹਾਨੂੰ ਬੇਨਤੀ ਹੈ ਕਿ ਜਿੰਨਾ ਵੀ ਸਫਾਈ ਦਾ ਪ੍ਰਬੰਧ ਹੈ ਉਨਾਂ ਤੁਹਾਡੇ ਵੱਲੋਂ ਹੀ ਕੀਤਾ ਜਾਵੇ ਅਤੇ ਪ੍ਰਬੰਧਕ ਕਮੇਟੀ ਜੀ ਆਪ ਜੀ ਨੂੰ ਇਹ ਵੀ ਬੇਨਤੀ ਹੈ ਕਿ ਜੋ ਵੀ ਉੱਥੇ ਇਹ ਕੂੜਾ ਕਰਕਟ ਸੁੱਟੇ ਉਹ ਡਸਟਬਿਨ ਦੇ ਵਿੱਚ ਹੀ ਪਾਇਆ ਜਾਵੇ ਵੱਡੇ ਵੱਡੇ ਡਸਟਬਿਨ ਲਗਾ ਦਿੱਤੇ ਜਾਣ ਜਾਂ ਜਿਸ ਤਰ੍ਹਾਂ ਵੀ ਮਰਜ਼ੀ ਉੱਥੇ ਮਗਰ ਸਫਾਈ ਦਾ ਅਭਿਆਨ ਸ਼ੁਰੂ ਕੀਤਾ ਜਾਵੇ ਅਤੇ ਬੇਨਤੀ ਹੈ ਕਿ ਸਹਾਇਤਾ ਕਰਨ ਦੀ ਵਿਧੀ ਦਿਓ